ਹਾਂ ਸਾਡੇ ਖੇਤਰ ਵਿੱਚ ਸਮੇਂ ਦੇ ਦੌਰਾਨ ਔਰਤਾਂ ਦੀ ਭੂਮਿਕਾ ਬਹੁਤ ਬਦਲੀ ਹੈ ਹੁਣ ਔਰਤਾਂ ਖੁੱਲ੍ਹ ਕੇ ਪੜ੍ਹਾਈ ਵੀ ਕਰਦੀਆਂ ਹਨ ਅਤੇ ਜੋਬ ਕੰਮ ਵੀ ਕਰਦੀਆਂ ਹਨ ਹੁਣ ਔਰਤਾਂ ਉੱਤੇ ਬਖਸ਼ਿਸ਼ਾਂ ਨਹੀਂ ਹਨ ਜੋ ਕਿ ਪਿਛਲੇ ਸਮੇਂ ਵਿੱਚ ਸਾਨੂੰ ਪਿਛਲੇ ਸਮੇਂ ਵਿੱਚ ਜਿਵੇਂ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਉਹ ਸਮਾਂ ਹੁਣ ਚਲਾ ਗਿਆ ਹੈ ਔਰਤ ਨੂੰ ਵੀ ਬਰਾਬਰ ਦਾ ਵੀ ਸਨਮਾਨ ਮਿਲਦਾ ਹੈ ਜਿੰਨਾ ਬੰਦਿਆਂ ਨੂੰ ਮਿਲਦਾ ਹੈ ਔਰਤ ਕਈ ਘਰਾਂ ਵਿੱਚ ਇਕੱਲੀਆਂ ਔਰਤਾਂ ਹੀ ਸਾਰੇ ਘਰ ਨੂੰ ਸੰਭਾਲਦੀਆਂ ਹਨ ਔਰਤਾਂ ਵੀ ਬੰਦਿਆਂ ਵਾਂਗ ਕੰਮ ਕਰਦੀਆਂ ਹਨ ਔਰਤਾਂ ਵੀ ਕਿਸੇ ਤੋਂ ਘੱਟ ਨਹੀਂ ਹਨ ਅੱਜ ਕੱਲ ਲੋਕਾਂ ਦੀ ਸੋਚ ਬਹੁਤ ਬਦਲ ਗਈ ਹੈ ਲੋਕ ਔਰਤਾਂ ਨੂੰ ਪੈਰ ਦੀ ਜੁੱਤੀ ਨਹੀਂ ਸਗ ਸਗੋਂ ਰਾਣੀ ਸਮਝਦੇ ਹਨ ਔਰਤ ਘਰ ਵਿੱਚ ਹੋਣੀ ਬਹੁਤ ਜ਼ਰੂਰੀ ਹੈ ਔਰਤ ਘਰ ਵਿੱਚ ਔਰਤ ਹੀ ਹੈ ਜੋ ਘਰ ਨੂੰ ਬੰਨ੍ਹ ਕੇ ਰੱਖਦੀ ਹੈ ਹੁਣ ਔਰਤਾਂ ਪਹਿਲਾਂ ਨਾਲੋਂ ਘੱਟ ਨਹੀਂ ਰਹੀਆਂ ਹਨ ਔਰਤਾਂ ਨੌਕਰੀ ਕਰਦੀਆਂ ਹਨ ਔਰਤਾਂ ਪੜ੍ਹਦੀਆਂ ਹਨ ਨੌਕਰੀ ਔਰਤਾਂ ਔਰਤਾਂ ਸਪੇਸ 'ਚ ਵੀ ਜਾਂਦੀਆਂ ਹਨ ਸਭ ਤੋਂ ਪਹਿਲਾਂ ਆਪਣੇ ਭਾਰਤ ਦੀ ਔਰਤ ਹੀ ਸੀ ਜੋ ਸਪੇਸ ਵਿੱਚ ਗਈ ਸੀ ਕਲਪਨਾ ਚਾਵਲਾ ਨੇ ਆਪਣੇ ਦੇਸ਼ ਦਾ ਨਾਮ ਉੱਚਾ ਕੀਤਾ ਸੀ ਹੁਣ ਹੁਣ ਔਰਤਾਂ ਨੂੰ ਸਤਿਕਾਰ ਮਿਲਣ ਲੱਗ ਪਿਆ ਹੈ ਔਰਤਾਂ ਪਹਿਲਾਂ ਵਾਂਗ ਨਹੀਂ ਰਹੀਆਂ ਹਨ ਔਰਤਾਂ ਉੱਚੀਆਂ ਉੱਚੀਆਂ ਉਡਾਰੀਆਂ ਭਰ ਰਹੀਆਂ ਹਨ